ਰੂਪਨਗਰ ਜ਼ਿਲ੍ਹੇ ਵਿੱਚ ਫਸਲਾਂ ਉਗਾਈਆਂ ਜਾਂਦੀਆਂ ਹਨ ਚਾਵਲ ਗੰਨਾ ਕਣਕ ਚਾਵਲ ਅਸੀਂ ਚਾਵਲ ਬਣਾ ਕੇ ਖਾ ਲੈਂਦੇ ਹਾਂ ਗੰਨਾ ਗੰਨੇ ਦਾ ਗੁੜ ਬਣਦਾ ਹੈ ਚੀਨੀ ਬਣਦੀ ਹੈ ਸ਼ੱਕਰ ਬਣਦੀ ਹੈ ਇਹਦਾ ਅਸੀਂ ਇਸਤੇਮਾਲ ਕਰਦੇ ਹਾਂ ਕਣਕ ਨੂੰ ਅਸੀਂ ਰੋਟੀ ਬਣਾ ਕੇ ਮੈਦਾ ਸੂਜੀ ਇਹ ਬਣਾ ਕੇ ਅਸੀਂ ਖਾਂਦੇ ਹਾਂ ਜੀ